ਪੰਜਾਬ ਦਾ ਖਾਣਾ ਹਰ ਜਗ੍ਹਾ 'ਤੇ ਹੀ ਬੜਾ ਮਸ਼ਹੂਰ ਹੈ ਪਰ ਜੇ ਆਪਾਂ ਕੁਝ ਪ੍ਰਸਿੱਧ ਰੈਸਟੋਰੋਂ ਜਾਂ ਸਥਾਨਾਂ ਦੀ ਗੱਲ ਕਰੀਏ ਤਾਂ ਜਿਵੇਂ ਜ਼ਿਮੀਦਾਰਾਂ ਦਾ ਢਾਬਾ ਹੋ ਗਿਆ ਜਾਂ ਹਵੇਲੀਆਂ ਹੋ ਗਈਆਂ ਜੋ ਰਾਹ ਜਾਂਦੇ ਹਾਈਵੇ ਦੇ ਉੱਤੇ ਖੁੱਲ੍ਹੀਆਂ ਹੋਈਆਂ ਨੇ ਜਾਂ ਜਿਵੇਂ ਜੇ ਆਪਾਂ ਪਟਿਆਲੇ ਦੀ ਗੱਲ ਕਰੀਏ ਤਾਂ ਜੱਗੀ ਸਵੀਟਸ ਹੋ ਗਿਆ ਜਾਂ ਮਲਹੋਤਰਾ ਸਵੀਟਸ ਹੋ ਗਿਆ ਐਵੇਂ ਜਿਹੇ ਨੇ ਬਾਕੀ ਹਰ ਪੰਜਾਬੀ ਜਿਹੜਾ ਖਾਣਾ ਹੈ ਉਹ ਹਰ ਜਗ੍ਹਾ 'ਤੇ ਹੀ ਵਧੀਆ ਮਿਲਦਾ ਪਰ ਕੁਝ ਗਿਣੇ ਚੁਣੇ ਜਿਹੇ ਆਪਾਂ ਰੈਸਟੋਰੈਂਟਾਂ ਦੀ ਗੱਲ ਕਰੀ ਤਾਂ ਇਨ੍ਹਾਂ 'ਚ ਨਾਮ ਆਉਂਦਾ